ਪਾਣੀ ਵਾਸਤੇ ਸਾਡੇ ਪਿੰਡਾਂ ਵਿੱਚ ਬਹੁਤ ਹੀ ਕਮੀ ਹੈ ਕਿਉਂਕਿ ਪਿੰਡਾਂ ਵਿੱਚ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜਿਸ ਕਰਕੇ ਜਿਵੇਂ ਸਿੰਚਾਈ ਦੇ ਖੇਤੀਬਾੜੀ ਵਾਸਤੇ ਬਹੁਤ ਪਾਣੀ ਚਾਹੀਦਾ ਹੁੰਦਾ ਹੈ ਅਤੇ ਪਿੰਡ ਵਾਸੀਆਂ ਨੂੰ ਵੀ ਪੀਣ ਵਾਸਤੇ ਪਾਣੀ ਦੀ ਸੁਵਿਧਾ ਨਹੀਂ ਹੁੰਦੀ ਜੋ ਉੱਥੇ ਕੀ ਥੱਲੜਾ ਪਾਣੀ ਹੁੰਦਾ ਹੈ ਬੋਰ ਵਾਲਾ ਇਸ ਕਰਕੇ ਉਹਨਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਤੇ ਉਹ ਪਿੰਡ ਵਾਲੇ ਫਿਰ ਆਪਣੇ ਸਰਪੰਚ ਨੂੰ ਜਾਂ ਫਿਰ ਵਾਟਰ ਬਾਕਸ ਮਹਿਕਮੇ ਵਾਲਿਆਂ ਨੂੰ ਕਹਿੰਦੇ ਹਨ ਜੋ ਕਿ ਪਾਣੀ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸਪਲਾਈ ਕੀਤਾ ਜਾਵੇ ਤਾਂ ਕਿ ਪੀਣਯੋੋਗ ਉਹ ਪਾਣੀ ਵੀ ਹੋਵੇ ਅਤੇ ਖੇਤੀਬਾੜੀ ਵਾਸਤੇ ਵੀ ਪਾਣੀ ਵੱਧ ਤੋਂ ਵੱਧ ਲੋੜ ਪੈਂਦੀ ਹੈ ਇਸ ਕਰਕੇ ਪਿੰਡ ਵਾਸੀ ਜੋ ਕਿ ਨਹਿਰੀ ਵਿਭਾਗ ਨਹਿਰੀ ਵਿਭਾਗ ਵਾਲਿਆਂ ਨੂੰ ਵੀ ਕਹਿੰਦੇ ਹਨ ਵੀ ਵੱਧ ਤੋਂ ਵੱਧ ਸਾਡੇ ਕੋਲ ਪਿੰਡਾਂ ਵਿੱਚ ਪਾਣੀ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇ ਪਿੰਡਾਂ ਵੱਲ ਨਾਲੇ ਪੀਣ ਵਾਲਾ ਪਾਣੀ ਵੀ ਵਾਟਰ ਵਰਕਸ ਦਾ ਜੋ ਕਿ ਆਉਣਾ ਚਾਹੀਦਾ ਹੈ ਇਸ ਵਾਸਤੇ ਉਹ ਬੋਰ ਵਾਲਾ ਪਾਣੀ ਹੁੰਦਾ ਹੈ ਇਹ ਖੇਤੀਬਾੜੀ ਵਿੱਚ ਵੀ ਬਹੁਤ ਜ਼ਿਆਦਾ ਸਾਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਘਰਾਂ ਵਿੱਚ ਵੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਇਸ ਕਰਕੇ ਪਿੰਡਾਂ ਵਾਲੇ ਸਰਪੰਚ ਨੂੰ ਜਾਂ ਕੁਛ ਵੀ ਸਾਰਿਆਂ ਨੂੰ ਪਾਣੀ ਵਾਸਤੇ ਵੱਧ ਤੋਂ ਵੱਧ ਅਪਲਾਈ ਸਪਲਾਈ ਕਰਨ ਵਾਸਤੇ ਸਰਕਾਰ ਨੂੰ ਵੀ ਬਹੁਤ ਜ਼ਿਆਦਾ ਕਹਿੰਦੇ ਹਨ ਅਤੇ ਨਾਲੇ